ਸਤਿ ਸ਼੍ਰੀ ਅਕਾਲ ਜੀ ਰੇਲਵੇ ਸਟੇਸ਼ਨ ਤੋਂ ਸਟੇਸ਼ਨ ਮਾਸਟਰ ਬੋਲਦੇ ਸਰ ਜਿਹੜੇ ਇੱਥੋਂ ਸਟੇ ਟ੍ਰੇਨਾਂ ਚੱਲਦੀਆਂ ਕਿਹੜੇ ਕਿਹੜੇ ਸ਼ਹਿਰ ਨੂੰ ਜੋੜਦੀਆਂ ਨਵਾਂਸ਼ਹਿਰ ਤੋਂ ਜਿਹੜੀਆਂ ਟ੍ਰੇਨਾਂ ਚੱਲਦੀਆਂ ਨੇ ਹਾਂਜੀ ਜੇ ਜਲੰਧਰ ਨੂੰ ਜਾਣਾ ਹੋਏ ਤਾਂ ਪੈਸੰਜਰ ਦਾ ਕੀ ਰੇਟ ਹੈ ਅੱਛਾ ਜੀ ਜੇ ਉੱਧਰ ਨੂੰ ਦਿੱਲੀ ਨੂੰ ਜਾਣਾ ਹੋਏ ਅਤੇ ਅਤੇ ਇੱਧਰ ਨੂੰ ਲੁਧਿਆਣੇ ਨੂੰ ਏਸੀ ਦਾ ਏਸੀ ਦਾ ਠੀਕ ਹੈ ਜੀ ਠੀਕ ਹੈ ਅਤੇ ਜੇ ਮੋਹਾਲੀ ਨੂੰ ਵੀ ਜਾਣਾ ਹੋਵੇ ਉੱਧਰ ਨੂੰ ਵੀ ਇੰਨਾਂ ਹੀ ਰੇ ਕਰਾਇਆ ਕਿ ਜ਼ਿਆਦਾ ਏ ਅੱਛਾ ਖਾਣ ਪੀਣ ਨੂੰ ਮਿਲ ਜਾਂਦਾ ਸਾਰਾ ਕੁਛ ਇੱਥੇ ਹਾਂਜੀ ਅੱਛਾ ਜੀ ਅੱਛਾ ਸਟੇਸ਼ਨ 'ਤੇ ਬਾਕੀ ਸਟੇਸ਼ਨ 'ਤੇ ਤਾਂ ਸਭ ਕੁਛ ਮਿਲ ਹੀ ਜਾਂਦਾ ਹੋਣਾ ਅੱਛਾ ਜੀ ਅੱਛਾ ਬਾਕੀ ਟ੍ਰੇਨ ਹੈ ਤਾਂ ਸਾਫ ਸੁਥਰੀ ਹੈ ਨਾ ਅੱਛਾ ਜੀ ਅੱਛਾ ਮੈਮ ਫਿਰ ਤੁਸੀਂ ਨਾ ਜਲੰਧਰ ਦੀਆਂ ਦੋ ਟਿਕਟਾਂ ਕਰ ਦਿਓ ਏਸੀ ਦੀਆਂ ਬਲਵਿੰਦਰ ਸਿੰਘ ਨਾਮ ਬਲਵਿੰਦਰ ਸਿੰਘ ਅਮਨਦੀਪ ਕੌਰ ਕਿੰਨੇ ਵਜੇ ਜਾਏਗੀ ਸ਼ਾਮ ਦੀ ਕਰ ਦਿਉ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ